ਪੰਜਾਬੀ ਭਾਸ਼ਾ ਜਿਹੜੇ ਕਿ ਸਾਡੀਆਂ ਦੋ ਮੁਢਲੀਆਂ ਲਿਪੀਆਂ ਸਨ ਇੱਕ ਖਰੋਸ਼ਟੀ ਅਤੇ ਇੱਕ ਬ੍ਰਹਮੀ ਕਿਉਂਕਿ ਸੰਸਕ੍ਰਿਤ ਅੰਗਰੇਜ਼ੀ ਇਹ ਵੀ ਜਿਹੜੀਆਂ ਹਨ ਬ੍ਰਹਮੀ ਲਿਪੀ ਚੋਂ ਹਨ ਜੋ ਕਿ ਖੱਬੇ ਤੋਂ ਸੱਜੇ ਪਾਸੇ ਲਿਖੀਆਂ ਜਾਂਦੀਆਂ ਹਨ ਅਤੇ ਪੰਜਾਬੀ ਦਾ ਜੋ ਵਿਕਾਸ ਹੈ ਉਹ ਵੀ ਇਹਨਾਂ ਦੇ ਅਧਾਰਿਤ ਹੀ ਹੋਇਆ ਹੈ ਜ਼ਿਆਦਾਤਰ ਜੋ ਭਾਸ਼ਾਵਾਂ ਹਨ ਸਾਡੀਆਂ ਉਹ ਸੰਸਕ੍ਰਿਤ ਦੇ ਵਿੱਚੋਂ ਹੀ ਨਿਕਲੀਆਂ ਹਨ ਸੰਸਕ੍ਰਿਤ ਵੀ ਬ੍ਰਹਮੀ ਲਿਪੀ ਚੋਂ ਹੀ ਹੈ ਜੋ ਕਿ ਖੱਬੇ ਤੋਂ ਸੱਜੇ ਪਾਸੇ ਲਿਖੀ ਜਾਂਦੀ ਹੈ ਲੇਕਿਨ ਜੋ ਖਰੋਸ਼ਟੀ ਲਿਪੀ ਹੈ ਉਹ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ ਜਿਵੇਂ ਕਿ ਉਰਦੂ ਫਾਰਸੀ ਆਦਿ ਅਤੇ ਇਹ ਜਿਹੜੀ ਸੰਸਕ੍ਰਿਤ ਦਾ ਪ੍ਰਭਾਵ ਹੈ ਇਹ ਕੇਵਲ ਪੰਜਾਬੀ 'ਤੇ ਹੀ ਨਹੀਂ ਸਾਡੀ ਹਿੰਦੀ ਅਤੇ ਹੋਰ ਭਾਸ਼ਾਵਾਂ ਪਰ ਵੀ ਪਿਆ ਹੈ ਔਰ ਕਈ ਸ਼ਬਦ ਪੰਜਾਬੀ ਦੇ ਵਿੱਚ ਸੰਸਕ੍ਰਿਤ ਦੇ ਜਿਉਂ ਤੋਂ ਤਿਉਂ ਹੀ ਲੈ ਲਿੱਤੇ ਗਏ ਹਨ ਜਿਵੇਂ ਕਿ ਪਿੱਤਰੀ ਪਿੱਤਰੀ ਮੀਨਸ ਪਿੱਤਰੀ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ ਲੇਕਿਨ ਸੰਸ ਪੰਜਾਬੀ ਦੇ ਵਿੱਚ ਵੀ ਇਸਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਅਤੇ ਅੰਗਰੇਜ਼ੀ ਦੇ ਵਿੱਚ ਵੀ ਕਈ ਸ਼ਬਦ ਜੋ ਹੈਂ ਜਿਸ ਤਰਾਂ ਕੀ ਨੀਅਰ ਨੀਅਰ ਮੇਨੇ ਨਜ਼ਦੀਕ ਅਤੇ ਇਹ ਇੱਕ ਸ ਬਿਹਾਰੀ ਦਾ ਦੋਹਾ ਹੈ ਕਿ ਨਿੰਦਕ ਨੀਅਰੇ ਰਾਖੀਏ ਨਿੰਦਕ ਨਿੰਦਾ ਕਰਨੇ ਵਾਲੇ ਕੋ ਨੀਅਰੇ ਰੱਖੀਏ ਮੀਨਸ ਨਜ਼ਦੀਕ ਰੱਖੋ ਜੋ ਨੀਅਰ ਸ਼ਬਦ ਜੋ ਹੈ ਉਹ ਹਿੰਦੀ ਦੇ ਵਿੱਚ ਵੀ ਪ੍ਰਚਲਿਤ ਹੈ ਅੰਗਰੇਜੀ 'ਚ ਵੀ ਪ੍ਰਚਲਿਤ ਹੈ ਅਤੇ ਇਸ ਤਰਾਂ ਜੋ ਹੈ ਪੰਜਾਬੀ ਹਿੰਦੀ ਤਾਂ ਮਤਲਬ ਲੱਗਦਾ ਹੈ ਕਿ ਇੱਕ ਦੂਜੇ ਦੇ ਬਹੁਤ ਹੀ ਕਲੋਜ਼ ਹਨ ਨੇੜੇ ਹਨ ਅਤੇ ਸੰਸਕ੍ਰਿਤ ਦੇ ਵਿੱਚੋਂ ਹੀ ਇਹਨਾਂ ਦਾ ਉਦਗਮ ਹੋਇਆ ਹੈ ਉਹਦੇ ਵਿੱਚੋਂ ਹੀ ਨਿੱਕਲੀਆਂ ਹਨ ਸੰਸਕ੍ਰਿਤ ਹੀ ਇਹਨਾਂ ਦੀ ਮਾਤਾ ਹੈ